ਪੰਜਾਬ ਦੇ ਬਹੁਤ ਹੀ ਪ੍ਰਮੁੱਖ ਇੱਦਾਂ ਦੇ ਕਾਰੋਬਾਰ ਹਨ ਜਿਹਨਾਂ ਨੇ ਬਹੁਤ ਹੀ ਸਫਲਤਾ ਹਾਸਿਲ ਕੀਤੀ ਆ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਕੇ ਜਿਵੇਂ ਕਿ ਜ਼ੋਪਰ ਹੋ ਗਿਆ ਐਂਡ ਗਾਨਾ ਗਾਨਾ ਐਪ ਬਹੁਤ ਹੀ ਜ਼ਿਆਦਾ ਫੇਮਸ ਸੀਗੀ ਜੋ ਬਾਕੀ ਹੋਰ ਡਿਲੀਵਰੀ ਐਪਸ ਹੋ ਗਈਆਂ ਜਿਵੇਂ ਕਿ ਰੈਪੀਡੋ ਉਹ ਹੋ ਗਈ ਬਲਿੰਕਿਟ ਹੋ ਗਈ ਇਹਨਾਂ ਨੇ ਵੀ ਬਹੁਤ ਵਧੀਆ ਅੱਜ ਦੇ ਮੌਕੇ ਦੇ ਵਿੱਚ ਬਹੁਤ ਹੀ ਵਧੀਆ ਕੰਮ ਮਿਲ ਗਿਆ ਇਹਨਾਂ ਨੂੰ ਵੀ ਅਤੇ ਜਿਵੇਂ ਸਟਾਰਟ ਟਪ ਪਹਿਲਾਂ ਸੀ ਉਭਰ ਜੋ ਜੋ ਕਿ ਦੋ ਹਜ਼ਾਰ ਨੌ ਦੇ ਵਿੱਚ ਸਟਾਰਟ ਹੋਈ ਸੀ ਉਭਰ ਤੋਂ ਬਾਅਦ ਓਲਾ ਹੋ ਗਈ ਇਨਡਰਾਈਵ ਹੋ ਗਈ ਇਨਡਰਾਈਵ ਵੀ ਅੱਜ ਕੱਲ੍ਹ ਬਹੁਤ ਚੱਲ ਰਹੀ ਆ ਕਿਉਂਕਿ ਇਹਨਾਂ ਦੇ ਪੇਅ ਵੀ ਬਹੁਤ ਘੱਟ ਨੇ ਅਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਾਂ ਟਰੈਵਲ ਕਰ ਸਕਦੇ ਹਾਂ

ਨਾਈਕਾ ਸ਼ੇਅਰ ਚੈਟ ਤੋਂ ਵੀ ਆਪਾਂ ਕੁਛ ਵੀ ਸ਼ੇਅਰ ਚੈਟ 'ਤੇ ਵੀ ਓਪਸ਼ਨਸ ਹੁੰਦੇ ਨੇ ਮੰਗਾ ਸਕਦੇ ਹਾਂ ਬਹੁਤ ਕੁਛ